ਮੈਂ ਆਪਣੀ ਦੋਹਤੀ ਵਾਸਤੇ ਸੋਹਣੇ ਸੋਹਣੇ ਕੱਪੜੇ ਬਣਾਏ ਸੀਗੇ ਉੱਨ ਦੇ ਕੱਪੜੇ ਵੀ ਬਣਾਏ ਸੀਗੇ ਟੋਪੀ ਸਵੈਟਰ ਬੋਟੂ ਛੋਟੇ ਛੋਟੇ ਔਰ ਸਿਲਾਈ ਕੱਪੜੇ ਸਿਲਾਈ ਵਾਲੇ ਵੀ ਬਹੁਤ ਪਿਆਰੇ ਪਿਆਰੇ ਬਣਾਏ ਸੀਗੇ ਇਹ ਬਹੁਤ ਮੈਨੂੰ ਬਹੁਤ ਮਜ਼ਾ ਆਇਆ ਸੀ ਬਣਾਉਣ ਵਿੱਚ ਉੱਨ ਦੇ ਕੱਪੜੇ ਜੋ ਹੱਥੀ ਬਣਾਉਦੇ ਹਾਂ ਉਹਨਾਂ ਦੇ ਵਿੱਚ ਨਿੱਘ ਵੀ ਬਹੁਤ ਜ਼ਿਆਦਾ ਹੁੰਦਾ ਅਤੇ ਉਹ ਮੈਂ ਬਹੁਤ ਪਿਆਰ ਨਾਲ ਬਣਾਏ ਸੀਗੇ ਇੱਕ ਬੱਚੇ ਦੇ ਪੋਤੀ ਦੇ ਕੱਪੜੇ ਦੋਹਤੀ ਦੇ ਤੋ ਬਹੁਤ ਵਧੀਆ ਲੱਗਿਆ ਮੈਨੂੰ ਬਣਾ ਕੇ ਕੱਪੜੇ ਛੋਟੇ ਛੋਟੇ ਕੱਪੜੇ ਬਣਾ ਕੇ ਬਹੁਤ ਵਧੀਆ ਲੱਗਿਆ ਧੰਨਵਾਦ